ਇਹ ਇਹ ਪੁਰਾਣੇ ਸਿੱਕੇ ਕੋਇਨ ਇਕੱਠੇ ਕਰਨ ਦਾ ਸ਼ੌਕ ਸੰਨ ਉੱਨੀ ਸੌ ਪੈਂਹਠ ਸੱਤਰ ਪੰਝੱਤਰ ਅੱਸੀ ਦੋ ਹਜ਼ਾਰ ਦੋ ਹਜ਼ਾਰ ਵੀਹ ਪੱਚੀ ਅੱਜ ਤੱਕ ਵੀ ਜਾਰੀ ਹੈ ਮੈਂ ਪੁਰਾਣੇ ਸਿੱਕੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਛੋਟੇ ਇੱਕ ਪੈਸਾ ਦੋ ਪੈਸੇ ਦਸ ਪੈਸੇ ਸਾਰੇ ਪੈਸੇ ਪੁਰਾਣੇ ਨੋਟ ਸਭ ਇਕੱਠੇ ਕੀਤੇ ਦੇ ਹੈ ਜਿਹੜੇ ਅਲੱਗ ਅਲੱਗ ਨੰਬਰਾਂ ਵਾਲੇ ਸੈਵਨ ਏਟ ਸਿਕਸ ਨੰਬਰ ਜਾਂ ਹੋਰ ਖਾਸ ਟੋਕਨ ਦੇ ਪੁਰਾਣੇ ਸਿੱਕੇ ਜਿਹਦੇ 'ਤੇ ਇੰਦਰਾ ਗਾਂਧੀ ਜਵਾਹਰ ਲਾਲ ਪਟੇਲ ਵਗੈਰਾ ਦੇ ਅੰਕਿਤ ਹੁੰਦੇ ਹਨ ਇਹ ਸਾਰੇ ਮੈਂ ਆਪਣੇ ਸ਼ੌਕ ਦੇ ਨਾਲ ਇਕੱਠੇ ਕੀਤੇ ਹਨ ਮੈਨੂੰ ਬਹੁਤ ਸ਼ੌਕ ਆ ਅੱਜ ਵੀ ਮੈਂ ਨਵੇਂ ਨਵੇਂ ਸਿੱਕੇ ਕਰ ਰਿਹਾ ਹਾਂ